ਹਾਂਜੀ ਜਦੋਂ ਆਪਾਂ ਕਿਤੇ ਟਰੈਕਿੰਗ ਕਰਦੇ ਹਾਂ ਨਾ ਤਾਂ ਅਕਸਰ ਉਹਦੇ ਵਿੱਚ ਕੀ ਹੈ ਖਰਾਬ ਰਸਤਿਆਂ ਦਾ ਜਾਂ ਖਰਾਬ ਮੌਸਮ ਦਾ ਆਪਾਂ ਨੂੰ ਸਾਹਮਣਾ ਕਰਨਾ ਪੈਂਦਾ ਸਾਡੇ ਨਾਲ ਵੀ ਹੋਇਆ ਅਸਲ ਦੇ ਵਿੱਚ ਅਸੀਂ ਹਿਮਾਚਲ ਦੀਆਂ ਪਹਾੜੀਆਂ 'ਤੇ ਟਰੈਕਿੰਗ ਕਰ ਰਹੇ ਸੀ ਤਾਂ ਉਸ ਸਮੇਂ ਕੀ ਹੈ ਸਾਨੂੰ ਖਰਾਬ ਰਸਤੇ ਦਾ ਸਾਹਮਣਾ ਕਰਨਾ ਪੈ ਗਿਆ ਜਦੋਂ ਐਵੇਂ ਦੀ ਸਿਚੁਏਸ਼ਨ ਆਉਂਦੀ ਹੈ ਤਾਂ ਆਪਾਂ ਨੂੰ ਕੀ ਆ ਉਸ ਸਮੇਂ ਫੈਸਲਾ ਲੈਣਾ ਹੁੰਦਾ ਜਿਹੜਾ ਆਪਣਾ ਉਹ ਲਿਆ ਫੈਸਲਾ ਬੜਾ ਮਹੱਤਵਪੂਰਨ ਆ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਕਿ ਜਦੋਂ ਅਸੀਂ ਹਿਮਾਚਲ ਦੀਆਂ ਪਹਾੜੀਆਂ 'ਤੇ ਟਰੈਕ ਕਰ ਰਹੇ ਸੀ ਤਾਂ ਸਾਨੂੰ ਇਸ ਤਰੀਕੇ ਨਾਲ ਇੱਕ ਰਸ ਖਰਾਬ ਰਸਤੇ ਦਾ ਸਾਹਮਣਾ ਕਰਨਾ ਪਿਆ ਜੋ ਕਿ ਬਹੁਤ ਅੱਗੋਂ ਟੁੱਟਿਆ ਸੀ ਅਤੇ ਉਹਦੇ ਉੱਤੇ ਕਾਫੀ ਵੱਡੇ ਵੱਡੇ ਪੱਥਰ ਜਿਹੜੇ ਕਿ ਖੜ੍ਹੇ ਯਾਨੀ ਕਿ ਰਸਤਾ ਇੱਕ ਹਿਸਾਬ ਦਾ ਬਲੋਕ ਅਤੇ ਖਰਾਬ ਸੀਗਾ ਉਦੋਂ ਦੌਰਾਨ ਕੀ ਹੈ ਉਦੋਂ ਫਿਰ ਅਸੀਂ ਸਿਚੁਏਸ਼ਨ ਜਿਹੜੀ ਕੀ ਆ ਕਿਵੇਂ ਸੰਭਾਲੀ ਜਾਂ ਅਸੀਂ ਫੈਸਲਾ ਇਹ ਲਿਆ ਉਦੋਂ ਕਿ ਸਭ ਤੋਂ ਪਹਿਲਾਂ ਅਸੀਂ ਮੌਸਮ ਦੇਖਿਆ ਉਹ ਰੋਡ ਦੇਖਿਆ ਕਿ ਅਸੀਂ ਅੱਗੇ ਜਾ ਸਕਦੇ ਹਾਂ ਕਿ ਨਹੀਂ ਜਾ ਸਕਦੇ ਅਤੇ ਆਪਦੀ ਸੁਰੱਖਿਆ ਦੇਖੀ ਟ੍ਰੈਕਿੰਗ ਕਰਦੇ ਸਮੇਂ ਆਪਣੀ ਸੁਰੱਖਿਆ ਬਹੁਤ ਜ਼ਰੂਰੀ ਹੁੰਦੀ ਹੈ ਸਭ ਤੋਂ ਪਹਿਲਾਂ ਕੋਈ ਵੀ ਫੈਸਲਾ ਪਹਿਲਾਂ ਆਪਣੀ ਸੁਰੱਖਿਆ ਵੇਖੋ ਜਾਂ ਜਿਹੜੀ ਉਹਨਾਂ ਵਿੱਚੋਂ ਰੁਕਾਵਟਾਂ ਆਉਣੀਆਂ ਉਹ ਦੇਖਣੀਆਂ ਪੈਂਦੀਆਂ ਕਿ ਕਿਸ ਤਰੀਕੇ ਨਾਲ ਵੀ ਆਪਾਂ ਉਹਨੂੰ ਹੈਂਡਲ ਕਰ ਸਕਦੇ ਹਾਂ ਅਤੇ ਉਸ ਤੋਂ ਬਾਅਦ ਅਸੀਂ ਫੈਸਲਾ ਉਹਦੇ 'ਚ ਲੈ ਲਿਆ ਕਿ ਅਸੀਂ ਥੋੜ੍ਹਾ ਜਿਹਾ ਕੋਈ ਹੋਰ ਰਸਤਾ ਲੱਭਣ ਦੀ ਕੋਸ਼ਿਸ਼ ਕੀਤੀ ਕਿ ਸਾਨੂੰ ਕਿਤੇ ਹੋਰ ਕੋਈ ਰਸਤਾ ਮਿਲ ਜੇ ਅਤੇ ਹੋਇਆ ਵੀ ਇਸ ਤਰੀਕੇ ਨਾਲ ਅਸੀਂ ਆਪਦੇ ਪੈਰ ਪਿੱਛੇ ਵਾਪਸ ਮੋੜੇ ਸਾਨੂੰ ਇੱਕ ਲ ਕਾਫੀ ਟਾਈਮ ਬਾਅਦ ਸਾਨੂੰ ਇੱਕ ਛੋਟਾ ਰਸਤਾ ਮਿਲ ਗਿਆ ਤਾਂ ਉਹਦੇ ਨਾਲ ਕੀ ਹੈ ਸਾਡੀ ਜਿਹੜੀ ਕੀ ਹੈ ਟਰੈਕਿੰਗ ਵਾਲੀ ਉਹ ਰਸਤਾ ਮਿਲਣ ਕਾਰਨ ਸਾਡੀ ਟਰੈਕਿੰਗ ਕੰਪਲੀਟ ਹੋਈ ਅਤੇ ਸਾਨੂੰ ਸਾਡੀ ਮੰਜ਼ਿਲ ਮਿਲ ਗਈ ਧੰਨਵਾਦ